ਹਾਂ ਮੈਂ ਸਾ ਰੇ ਗਾ ਮਾ ਪਾ ਰਿਐਲਿਟੀ ਸ਼ੋ ਦੇਖਦੀ ਹਾਂ ਮੈਨੂੰ ਸਭ ਤੋਂ ਜ਼ਿਆਦਾ ਹਰਸ਼ ਸਿਕੰਦਰ ਬਹੁਤ ਅੱਛਾ ਲੱਗਦਾ ਹੈ ਉਸਨੇ ਬਹੁਤ ਛੋਟੀ ਉਮਰ ਦੇ ਵਿੱਚ ਹੀ ਗਾਇਕੀ ਵਿੱਚ ਆਪਣਾ ਬਹੁਤ ਉੱਚਾ ਸਥਾਨ ਪ੍ਰਾਪਤ ਕਰ ਲਿਆ ਹੈ ਮੈਨੂੰ ਉਸ ਨੂੰ ਦੇਖ ਕੇ ਬਹੁਤ ਜ਼ਿਆਦਾ ਪ੍ਰੇਰਨਾ ਮਿਲਦੀ ਹੈ ਮੈਨੂੰ ਜਿਹੜੇ ਉਹਦੇ ਗਾਣੇ ਦੇ ਬੋਲ ਹੈ ਬਹੁਤ ਜ਼ਿਆਦਾ ਪਸੰਦ ਆਉਂਦੇ ਹਨ ਵੈਸੇ ਤਾਂ ਮੈਨੂੰ ਬਹੁਤ ਜ਼ਿਆਦਾ ਗਾਇਕੀ ਦਾ ਕੋਈ ਸ਼ੌਂਕ ਨਹੀਂ ਹੈ ਪਰ ਫਿਰ ਵੀ ਜਦੋਂ ਵੀ ਮੈਨੂੰ ਕੁਛ ਸੁਣਨ ਦਾ ਮਨ ਕਰਦਾ ਹੈ ਤਾਂ ਮੈਂ ਉਸਦੇ ਗੀਤਾਂ ਨੂੰ ਉਹਦੇ ਉਸਨੇ ਜ਼ਿਆਦਾਤਰ ਭਜਨ ਹੀ ਗਾਏ ਹਨ ਤਾਂ ਉਹ ਜ਼ਿਆਦਾ ਮੈਂ ਸੁਣਨਾ ਪਸੰਦ ਕਰਦੀ ਹਾਂ